ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਪੇਂਟਰ ਬੋਲਦੇ ਹਾਂ ਹਾਂਜੀ ਹਾਂਜੀ ਤੁਸੀਂ ਸਿੰਪਲ ਸਿੰਪਲ ਪੇਂਟ ਕਰਵਾਉਣਾ ਜਾਂ ਸ਼ੀਟਸ ਵਗੈਰਾ ਲਗਵਾਉਣੀਆ ਹੈ ਸਾਡੇ ਕੋਲ ਪਲੇਟਸ ਵੀ ਨੇ ਸ਼ੀਟਸ ਵੀ ਨੇ ਸਿੰਪਲ ਪੇਂਟ ਵੀ ਕਰਦੇ ਹਾਂ ਹਾਂਜੀ ਕਿੰਨੇ ਰੂਮ ਨੇ ਤੁਸੀਂ ਸਾਨੂੰ ਦੁਬਾਰਾ ਦੱਸਣਾ ਅੱਛਾ ਜੀ ਤੁਸੀਂ ਹਾਂਜੀ ਜ਼ਰੂਰ ਹਾਂਜੀ ਸਾਡੇ ਕੋਲ ਬਹੁਤ ਵਧੀਆ ਵਧੀਆ ਡਿਜ਼ਾਇਨ ਪਏ ਆ ਰੇਟਸ ਵੀ ਸਾਡੇ ਲੋਅ ਹੀ ਹੈ ਮਤਲਬ ਠੀਕ ਪ੍ਰਾਈਸ ਹੈ ਅਤੇ ਬਾਕੀਆਂ ਨਾਲੋਂ ਅਤੇ ਅਸੀਂ ਤੁਹਾਨੂੰ ਕੁਛ ਡਿਸਾਈਨ ਦੀਆਂ ਪਿਕਸ ਭੇਜ ਦਿੰਦੇ ਹਾਂ ਤੁਸੀਂ ਸਲੈਕਟ ਕਰਕੇ ਸਾਨੂੰ ਦੱਸ ਦੇਣਾ ਹਾਂਜੀ ਤੁਹਾਨੂੰ ਇੱਕ ਰੂਮ 'ਤੇ ਦਸ ਕੁ ਹਜ਼ਾਰ ਦਾ ਖਰਚਾ ਆ ਜਾਵੇਗਾ ਹਾਂਜੀ ਕੁਆਲਿਟੀ ਬਹੁਤ ਵਧੀਆ ਮਿਲੇਗੀ ਸਾਡੇ ਕੋਲੋਂ ਹਾਂਜੀ ਇਹ ਤੁਹਾਡਾ ਦਸ ਸਾਲ ਤੱਕ ਤਾਂ ਚੱਲ ਹੀ ਜਾਵੇਗਾ ਕਿਉਂਕਿ ਸਾਡੇ ਕੋਲ ਬਹੁਤ ਵਧੀਆ ਕੁਆਲਿਟੀ ਹੈ ਹਾਂਜੀ ਅਸੀਂ ਤੁਹਾਨੂੰ ਡਿਜ਼ਾਇਨ ਭੇਜ ਦਾਂਗੇ ਤੁਸੀਂ ਵਿੱਚੋਂ ਸਲੈਕਟ ਕਰਕੇ ਸਾਨੂੰ ਦੱਸ ਦੇਣਾ ਹਾਂਜ ਹਾਂਜੀ ਛੱਤ 'ਤੇ ਵੀ ਕਰ ਦਿਆਂਗੇ ਛੱਤ 'ਤੇ ਤੁਸੀਂ ਸਿੰਪਲ ਪੇਂਟ ਕਰਵਾਉਣਾ ਜਾਂ ਉੱਥੇ ਵੀ ਤੁਸੀਂ ਫਲੈਕਸ ਵਗੈਰਾ ਉੱਦਾਂ ਕਰਵਾਉਣਾ ਹਾਂਜੀ ਠੀਕ ਹੈ ਜੀ ਉਹਨਾਂ ਦੇ ਵੀ ਅਸੀਂ ਤੁਹਾਨੂੰ ਅਲੱਗ ਤੋਂ ਡਿਜ਼ਇਨ ਭੇਜ ਦਿਆਂਗੇ ਅਤੇ ਤੁਹਾਡਾ ਕੰਮ ਅਸੀਂ ਜਲਦੀ ਤੋਂ ਜਲਦੀ ਕਰਦਾਂਗੇ ਹਾਂਜੀ ਇੱਕ ਰੂਮ 'ਤੇ ਤਿੰਨ ਚਾਰ ਦਿਨ ਲੱਗ ਸਕਦੇ ਹੈ ਤੁਹਾਨੂੰ ਹਾਂਜੀ ਤੁਹਾਨੂੰ ਕਦੋਂ ਤੱਕ ਕੰਪਲੀਟ ਚਾਹੀਦਾ ਹਾਂਜੀ ਠੀਕ ਹੈ ਜੀ ਹਾਂਜੀ ਨਹੀਂ ਜੀ ਕੁਆਲਟੀ ਬਹੁਤ ਵਧੀਆ ਮਿਲੇਗੀ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਸਾਨੂੰ ਆਪਣਾ ਨੰਬਰ ਦੱਸ ਦਿਓ ਅਸੀਂ ਤੁਹਾਨੂੰ ਤੁਹਾਡੇ ਨੰਬਰ 'ਤੇ ਕੁਛ ਡਿਜ਼ਾਇਨ ਦੀਆਂ ਫੋਟੋਸ ਭੇਜਦੇ ਹਾਂ ਤੁਸੀਂ ਵਿੱਚੋਂ ਸਲੈਕਟ ਕਰਕੇ ਦੱਸਣਾ ਅਸੀਂ ਉਦੋਂ ਹੀ ਕੰਮ ਸ਼ੁਰੂ ਕਰ ਦਿਆਂਗੇ ਤੁਹਾਡਾ ਕਰਨਾ ਹਾਂਜੀ ਜੀ ਹਾਂਜੀ ਨੰਬਰ ਦੱਸ ਦਿਓ ਜੀ ਤੁਸੀਂ ਆਪਣਾ